ਜੀ ਹਾਂ ਪਸ਼ੂ ਪਾਲਣ ਵਿੱਚ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਮੇਨ ਚੁਣੌਤੀਆਂ ਹਨ ਪਸ਼ੂ ਰੱਖਣ ਦੇ ਵਿੱਚ ਪਸ਼ੂ ਮਤਲਬ ਮੱਝਾਂ ਜਾਂ ਗਾਵਾਂ ਜੋ ਗਾਵਾਂ ਹੁੰਦੀਆਂ ਹਨ ਇਹਨਾਂ ਨੂੰ ਜੋ ਮੇਨ ਚੁਣੌਤੀਆਂ ਹੁੰਦੀਆਂ ਹਨ ਇਹਨਾਂ ਦੀ ਬਰੀਡਿੰਗ ਨੂੰ ਲੈ ਕੇ ਹੁੰਦਾ ਹੈ ਜ਼ਿਆਦਾਤਰ ਗਾਵਾਂ ਹਨ ਜੋ ਜੋ ਆਸ ਨਹੀਂ ਰਹਿੰਦੀਆਂ ਅਤੇ ਪ੍ਰੈਗਨੈਂਟ ਨੇ ਬਹੁਤ ਟਾਈਮ ਬਾਅਦ ਹੁੰਦੀਆਂ ਹਨ ਜੇਕਰ ਉਹਨਾਂ ਦੇ ਕੋਈ ਟੀਕਾ ਵਗੈਰਾ ਲਗਾਇਆ ਲਗਵਾਇਆ ਜਾਵੇ ਤਾਂ ਉਹ ਆਪਣਾ ਬੱਚਾ ਜਲਦੀ ਜਲਦੀ ਸਾਬਤ ਨਹੀਂ ਕਰਦੀਆਂ ਮੇਨ ਚੁਣੌਤੀਆਂ ਤਾਂ ਇਹਨਾਂ ਦੀ ਬਰੀਡਿੰਗ ਨੂੰ ਲੈ ਕੇ ਹਨ ਵੀ ਇਹਨਾਂ ਦੀ ਕੋਈ ਵਧੀਆ ਬਰੀਡਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਜੋ ਮੱਝਾਂ ਹਨ ਮੱਝਾਂ ਦੇ ਵਿੱਚ ਵੀ ਇਹ ਪ੍ਰੈਗਨੈਂਸੀ ਵਾਲਾ ਘੱਟ ਪਾਇਆ ਜਾਂਦਾ ਹੈ ਪਰ ਮੱਝਾਂ ਦੇ ਵਿੱਚ ਜੋ ਮੇਨ ਹੈ ਉਹ ਉਹਨਾਂ ਦੀ ਬਰੀਡ ਹੈ ਜੋ ਇਹ ਕਿਸਾਨਾਂ ਨੂੰ ਵਧੀਆ ਤੋਂ ਵਧੀਆ ਬਰੀਡਾਂ ਦਿੱਤੀਆਂ ਜਾਣ ਜੇਕਰ ਤੁਸੀਂ ਕੁਝ ਦਿਨਾਂ ਲਈ ਦੂਰ ਹੋਂ ਤਾਂ ਜਾਨਵਰਾਂ ਦੀ ਦੇਖਭਾਲ ਜੋ ਘਰ ਦੇ ਵਿੱਚ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਸ ਜਿਨ੍ਹਾਂ ਨੇ ਵੀ ਮੱਝਾਂ ਅਤੇ ਗਾਵਾਂ ਰੱਖੀਆਂ ਹਨ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰ ਜਿਹਨਾਂ ਨੂੰ ਬਈਏ ਕਿਹਾ ਜਾਂਦਾ ਹੈ ਉਹ ਬਿਹਾਰ ਦੇ ਲੋਕ ਜਾਂ ਯੂਪੀ ਤੋਂ ਲੋਕ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਨਾਲ਼ ਇੱਕ ਤਰ੍ਹਾਂ ਦੀ ਨੌਕਰੀ ਕਰਦੇ ਹਨ ਅਤੇ ਉਹ ਜ਼ਿਆਦਾਤਰ ਕੰਮ ਕਿਸਾਨ ਮੱਝਾਂ ਦੀ ਦੇਖਭਾਲ ਆਪ ਨਾ ਕਰਕੇ ਉਹਨਾਂ ਤੋਂ ਕਰਵਾਉਂਦੇ ਹਨ ਆਪ ਜੀ ਨੇ ਅੱਗੇ ਪੁੱਛਿਆ ਹੈ ਕਿ ਤੁਸੀਂ ਜਾਨਵਰਾਂ ਦੇ ਸੰਬੰਧ ਵਿੱਚ ਕੋਈ ਬੁਰੀ ਘਟਨਾ ਦਾ ਅਨੁਭਵ ਕੀਤਾ ਹੈ ਜੀ ਹਾਂ ਅਸੀਂ ਕਾਫ਼ੀ ਵਾਰ ਇੱਦਾਂ ਹੁੰਦਾ ਹੈ ਕਿ ਜੋ ਸਾਡੀਆਂ ਪਿੰਡਾਂ ਦੇ ਵਿੱਚ ਗਾਵਾਂ ਹੁੰਦੀਆਂ ਹਨ ਉਹਨਾਂ ਨੂੰ ਜੋ ਵਧੀਆ ਦਵਾਈਆਂ ਹਨ ਜੋ ਵਧੀਆ ਹਸਪਤਾਲ ਹਨ ਜੋ ਵਧੀਆ ਸੁਵਿਧਾ ਹਨ ਪਿੰਡਾਂ ਦੇ ਵਿੱਚ ਜ਼ਿਆਦਾਤਰ ਨਹੀਂ ਹਨ ਸਿਰਫ਼ ਇਹੀ ਹੱਲ ਹੈ ਕਿ ਪਿੰਡਾਂ ਦੇ ਵਿੱਚ ਝੋਲਾ ਛਾਪ ਡਾਕਟਰ ਜ਼ਿਆਦਾ ਹਨ ਜੋ ਆਪਣਾ ਟ੍ਰੀਟਮੈਂਟ ਸਹੀ ਤਰੀਕੇ ਦੇ ਨਾਲ਼ ਨਹੀਂ ਕਰਦੇ ਜਿਨ੍ਹਾਂ ਦੇ ਨਾਲ਼ ਕਾਫ਼ੀ ਮੱਝਾਂ ਗਾਵਾਂ ਦੀਆਂ ਜਾਨਾਂ ਵੀ ਜਾਂਦੀਆਂ ਹਨ ਜੋ ਆਪਣਾ ਇੱਕ ਥੋਕ ਦੇ ਰੇਟ 'ਤੇ ਦਵਾਈਆਂ ਲਿਆ ਕੇ ਉਹ ਮੱਝਾਂ ਅਤੇ ਗਾਵਾਂ ਦੇ ਉੱਤੇ ਐਕਸਪੈਰੀਮੈਂਟ ਕਰਦੇ ਹਨ ਇਹ ਸਾਡਾ ਇੱਕ ਬੁਰਾ ਅਨੁਭਵ ਹੈ ਅਸੀਂ ਸ ਸਰਕਾਰ ਵੱਲੋਂ ਇਹ ਚਾਹੁੰਦੇ ਹਾਂ ਕਿ ਪਿੰਡਾਂ ਦੇ ਵਿੱਚ ਵਧੀਆ ਹਸਪਤਾਲ ਬਣਾਏ ਜਾਣ ਅਤੇ ਸਾਨੂੰ ਵਧੀਆ ਬਰੀਡਾਂ ਦੀਆਂ ਗਾਵਾਂ ਅਤੇ ਮੱਝਾਂ ਦੀਆਂ ਬਰੀਡਾਂ ਦਿੱਤੀਆਂ ਜਾਣ ਅਤੇ ਸਰਕਾਰ ਇਸ ਵੱਲ ਜ਼ਰੂਰ ਗੌਰ ਕਰੇ ਅਤੇ ਝੋਲਾ ਛਾਪ ਜੋ ਡਾਕਟਰ ਹਨ ਜਿਹਨਾਂ ਕੋਲ ਕੋਈ ਵੀ ਡਿਗਰੀ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸਰਟੀਫ਼ਿਕੇਟ ਨਹੀਂ ਹੁੰਦਾ ਇਹ ਪਿੰਡਾਂ ਦੇ ਵਿੱਚ ਜ਼ਿਆਦਾ ਪਾਏ ਜਾਂਦੇ ਹਨ ਇਹ ਸਾਡਾ ਅਨੁਭਵ ਹੈ